ਸਾਡੇ ਖੇਤਰ ਦੇ ਵਿੱਚ ਹਰ ਸਕੂਲ ਹੈ ਜੋ ਹਰ ਸਕੂਲ ਉਹ ਆਪਣੇ ਆਪ ਵਿੱਚ ਹੀ ਕਿਉਂਕਿ ਵਿਸ਼ਾ ਹੈ ਜੋ ਇਹ ਕਲਾ ਦਾ ਵਿਸ਼ਾ ਹੈ ਉਹ ਹਮੇਸ਼ਾਂ ਅਲੱਗ ਤੋਂ ਰਹਿੰਦਾ ਹੈ ਵੱਖ ਵੱਖ ਕਲਾਵਾਂ ਜੋ ਬੱਚਿਆਂ ਨੂੰ ਸਿਖਾਈਆਂ ਜਾਂਦੀਆਂ ਹਨ ਅਤੇ ਤਾਂ ਜੋ ਹਰ ਸਕੂਲ ਹੈ ਉਹ ਆਪਣੇ ਆਪਣੇ ਪੱਧਰ 'ਤੇ ਕਲਾ ਨੂੰ ਅੱਗੇ ਵਧਾਉਣ ਦੇ ਲਈ ਆਪਣੀ ਕੋਸ਼ਿਸ਼ ਨਿਰੰਤਰ ਰੱਖਦਾ ਹੈ ਤਾਂ ਜਿਹੜਾ ਬਹੁਤ ਸਾਰੇ ਜਿਹੜੇ ਸਕੂਲਾਂ ਦੇ ਵਿੱਚ ਪ੍ਰੋਗਰਾਮ ਕਰਵਾਏ ਜਾਂਦੇ ਹਨ ਬਹੁਤ ਸਾਰੇ ਬਹੁਤ ਸਾਰੀਆਂ ਜਿਹੜੀਆਂ ਉਹਦੇ ਪ੍ਰੋਗਰਾਮ ਰਖਵਾਏ ਜਾਂਦੇ ਹਨ ਜਿਸਦੇ ਵਿੱਚ ਕਲਾ ਪ੍ਰਦਰਸ਼ਨੀ ਹੁੰਦੀ ਹੈ ਬੱਚਿਆਂ ਦੁਆਰਾ ਕੀਤੀ ਗਈ ਕਲਾ ਪ੍ਰਦਰਸ਼ਨੀ ਹੁੰਦੀ ਹੈ ਅਤੇ ਵੱਖ ਵੱਖ ਜੇ ਆਪਾਂ ਸਮਝੀਏ ਕਿ ਪੱਧਰਾਂ ਦੇ ਉੱਤੇ ਜਿਹੜੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਜਿਵੇਂ ਪਹਿਲਾਂ ਸਭ ਤੋਂ ਛੋਟਾ ਆਪਣੇ ਆ ਸਕੂਲ ਦੇ ਵਿੱਚ ਹੀ ਬੱਚਿਆਂ ਦੇ ਵਿੱਚ ਆਪਸ ਦੇ ਵਿੱਚ ਇਹਨਾਂ ਨੂੰ ਵਿਸ਼ੇ ਦਿੱਤੇ ਜਾਂਦੇ ਹਨ ਅਤੇ ਉਸ ਉੱਤੇ ਕਲਾ ਦੀਆਂ ਜੋ ਪ੍ਰੋਗਰਾਮ ਹੈ ਉਹ ਕਰਵਾਏ ਜਾਂਦੇ ਹਨ ਅਤੇ ਉਹਦੇ ਵਿੱਚ ਉਹ ਆਪਣੀ ਜੋ ਕਲਾ ਹੈ ਉਹ ਪੇਸ਼ ਕਰਦੇ ਹਨ ਫੇਰ ਇਹ ਅੱਗੇ ਅੱਗੇ ਵੱਧਦੇ ਰਹਿ ਜਾਂਦੇ ਰਾਜ ਪੱਧਰ ਤੱਕ ਇਹ ਚੱਲ ਜਾਂਦੇ ਹਨ ਅਤੇ ਪੰਜਾਬ ਦੇ ਵਿੱਚ ਉੱਭਰ ਰਹੀ ਲਲਿਤ ਕਲਾ ਅਕੈਡਮੀ ਹੈ ਇੱਕ ਜੋ ਕਿ ਇਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਵੱਧ ਚੜ੍ਹ ਕੇ ਇਸਦੇ ਵਿੱਚ ਹਿੱਸਾ ਲੈ ਰਹੀ ਹੈ ਉਨ੍ਹਾਂ ਨੇ ਫੈਸਲਾ ਲਿਆ ਹੈ ਕਿ ਲੋਕਾਂ ਨੂੰ ਕਲਾ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਜਿਵੇਂ ਪੰਜਾਬ ਦੇ ਵਿੱਚ ਵੱਖ ਵੱਖ ਕਲਾ ਦੇ ਜਿਹੜੇ ਹਨ ਕਿ ਇਕੱਲੀ ਸਿਰਫ ਹਸਤ ਕਲਾ ਨਹੀਂ ਚਿੱਤਰਕਾਰੀ ਹੀ ਨਹੀਂ ਜਿਸ ਦੇ ਵਿੱਚ ਹੋਰ ਵੀ ਕਾਫੀ ਜਿਹੜੀਆਂ ਕਲਾ ਨੇ ਉਹ ਸ਼ਾਮਿਲ ਹਨ ਜਿਵੇਂ ਅੱਜ ਕੱਲ੍ਹ ਦੇ ਵਿੱਚ ਫੋਟੋਗ੍ਰਾਫੀ ਇਹ ਵੀ ਤਾਂ ਇਹ ਜਿਹੜੇ ਲਲਿਤ ਕਲਾ ਅਕੈਡਮੀ ਹੈ ਇਹ ਸੈਕ ਸੈਕਟਰ ਸਤਾਰ੍ਹਾਂ ਦੇ ਵਿੱਚ ਇਨ੍ਹਾਂ ਨੇ ਜਿਹੜਾ ਪੁੱਲ ਬਣਾਇਆ ਹੈ ਇਸ ਦੇ ਉੱਤੇ ਇਹ ਜਿਹੜੀ ਕਲਾ ਦਾ ਇਨ੍ਹਾਂ ਨੂੰ ਦਿਖਾਇਆ ਜਾਂਦਾ ਹੈ ਵੱਖ ਵੱਖ ਜਿਹੜੇ ਕਲਾਕਾਰ ਹਨ ਚਿੱਤਰਕਾਰ ਹਨ ਉਨ੍ਹਾਂ ਦੀਆਂ ਚਿੱਤਰਕਾਰੀਆਂ ਨੂੰ ਉੱਥੇ ਪੇਸ਼ ਕੀਤਾ ਜਾਂਦਾ ਹੈ ਜੇ ਉੱਥੋਂ ਦੇਖ ਕੇ ਕੀ ਹੈ ਅੱਗੇ ਉਸਦੇ ਲਈ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਤਿਆਰ ਹੁੰਦੇ ਹਨ ਅਤੇ ਵੱਖ ਵੱਖ ਚਿੱਤਰਕਾਰਾਂ ਬਾਰੇ ਜਾਣਕਾਰੀ ਹਾਸਿਲ ਕਰਦੇ ਹਨ